ਮੈਂ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਤੱਕ ਪੜ੍ਹਿਐਂ ਅਤੇ ਉੱਥੇ ਦਾ ਵਾਤਾਵਰਨ ਅਤੇ ਟੀਚਰ ਬਹੁਤ ਹੀ ਅੱਛੇ ਸੀ ਉਹ ਆਪ ਹੀ ਸਭ ਕੁੱਝ ਕੋਲ਼ ਬਹਿ ਕੇ ਕਰਾਉਂਦੇ ਸੀ ਅਤੇ ਉਸ ਤੋਂ ਬਾਅਦ ਮੈਂ ਛੇਵੀਂ ਵਿੱਚ ਮਿਡਲ ਸਕੂਲ ਵਿੱਚ ਦਾਖ਼ਲਾ ਲਿਆ ਅਤੇ ਉੱਥੇ ਦੇ ਟੀਚਰ ਵੀ ਬਹੁਤ ਹੀ ਵਧੀਆ ਸੀ ਉੱਥੇ ਮੈਂ ਮੈਥ ਵਿਗਿਆਨ ਅਤੇ ਹੋਰ ਕਈ ਹੋਰ ਸਬਜੈਕਟ ਜਿਵੇਂ ਕਿ ਕੰਪਿਊਟਰ ਉਹ ਵੀ ਸਿੱਖਿਆ ਅਤੇ ਉਹ ਆਪ ਹੀ ਸਿਖਾਉਂਦੇ ਸੀ ਅਤੇ ਬਹੁਤ ਹੀ ਵਧੀਆ ਅੰਕਾਂ ਨਾਲ਼ ਮੈਂ ਉੱਥੋਂ ਪਾਸ ਕੀਤਾ ਉਸ ਤੋਂ ਬਾਅਦ ਮੈਂ ਨੌਵੀਂ ਸ਼ਹਿਰ ਵਿੱਚ ਕੀਤੀ ਅਤੇ ਉੱਥੇ ਮੇਰੇ ਕਈ ਸਾਰੇ ਦੋਸਤ ਮਿੱਤਰ ਬਣੇ ਅਤੇ ਜੋ ਮੇਰੇ ਨਾਲ਼ ਮਿੱਤਰ ਸੀ ਉਹ ਬਹੁਤ ਹੀ ਵਧੀਆ ਸੀ ਉਹ ਮੇਰੇ ਨਾਲ਼ ਰਹਿ ਕੇ ਪੜ੍ਹਾਈ ਕਰਦੇ ਸੀ ਮੇਰੇ ਨਾਲ਼ ਹੀ ਉੱਥੇ ਜਾਂਦੇ ਸੀ ਅਤੇ ਮੈਂ ਹਰ ਕਲਾਸ ਅਤੇ ਸਬਜੈਕਟ ਵਿੱਚ ਬਹੁਤ ਹੀ ਵਧੀਆ ਅੰਕ ਪ੍ਰਾਪਤ ਕੀਤੇ ਅਤੇ ਮੈਨੂੰ ਮੈਥ ਬਹੁਤ ਹੀ ਵਧੀਆ ਲੱਗਿਆ ਅਤੇ ਮੈਂ ਫਿਰ ਕੋਲਜ ਬਾਰ੍ਹਵੀਂ ਤੱਕ ਪੜ੍ਹਾਈ ਇੱਥੇ ਸ਼ਹਿਰ ਵਿੱਚ ਕੀਤੀ ਅਤੇ ਉਸ ਤੋਂ ਬਾਅਦ ਮੈਂ ਕੋਲਜ ਗਿਆ ਅਤੇ ਕੋਲਜ ਵਿੱਚ ਮੈਂ ਕੰਪਿਊਟਰ ਬੀ ਸੀ ਏ ਕੀਤੀ ਅਤੇ ਉੱਥੇ ਮੇਰੇ ਹੋਰ ਵੀ ਕਈ ਦੋਸਤ ਨਾਲ਼ ਹੀ ਮੇਰੇ ਨਾਲ਼ ਹੀ ਲੱਗ ਗਏ ਮੇਰੇ ਨਾਲ਼ ਹੀ ਉਹ ਬੀ ਸੀ ਏ ਅਤੇ ਹੋਰ ਮੇਰੇ ਨਾਲ਼ ਦੇ ਦੋਸਤ ਆਈਲੈਟਸ ਵੀ ਕਰਨ ਲੱਗ ਪਏ ਅਤੇ ਕਈ ਅਤੇ ਹੋਰ ਆਪਣੇ ਭਰਾ ਨਾਲ਼ ਜਾਂ ਹੋਰ ਕਿਸੇ ਆਪਣੇ ਰਿਸ਼ਤੇਦਾਰ ਨਾਲ਼ ਕੰਮ ਸਿੱਖਣ ਲੱਗ ਪਏ ਅਤੇ ਨਾਲ਼ ਹੀ ਆਪਣੀ ਪੜ੍ਹਾਈ ਵੀ ਕਰਨ ਲੱਗ ਪਏ